ਸਾਹਿਤ ਕਵਿਤਾ ਜਿੱਦਾਂ ਮਤਲਬ ਸਾਹਿਤ ਕਵਿਤਾ ਨੂੰ ਵਿੱਚ ਆਪਣੇ ਢੰਗ ਵਿੱਚ ਰੱਖ ਕੇ ਵਰਤੋਂ ਕਰਦੇ ਹੈ ਉਹ ਕਵਿਤਾ ਜਿਹੜੀ ਹੈ ਕਵਿਤਾ ਨੂੰ ਬ ਵਧੀਆ ਤੁਕ ਤਰੀਕੇ ਨਾਲ ਵਧੀਆ ਰੱਖ ਕੇ ਮੈਂ ਕਵਿਤਾ ਬਣਾ ਕੇ ਆਪਣੇ ਸਾਡੇ ਮੂਹਰੇ ਰੱਖਦੇ ਹੈ ਕਵਿਤਾ ਵਾ ਵਧੀਆ ਢੰਗ ਤਰੀਕੇ ਨਾਲ ਜਿਹੜਾ ਉਹ ਕਲਾਲ ਜਿਹੜਾ ਉਹ ਕਵਿਤਾ ਲਿਖਦਾ ਉਹ ਬਹੁਤ ਵਧੀਆ ਇਨਵਾਇਰਮੈਂਟ ਦੇਖ ਕੇ ਆਲੇ ਦੁਆਲੇ ਹਰਾ ਮੋਡਾ ਦੇਖ ਕੇ ਉਹ ਸਭ ਕੁਝ ਦੇਖ ਕੇ ਉਹਨੇ ਆਪਣੇ ਹਿਸਾਬ ਨਾਲ ਉਹਨੇ ਕਵਿਤਾ ਤੁਹਾਨੂੰ ਤਿਆਰ ਕਰਕੇ ਦੇਣੀ